ਅਸੀਂ ਆਪਣੇ ਮਹਿਮਾਨਾਂ ਨਾਲ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਹਾਂ ਉਸਦਾ ਸਤਿਕਾਰ ਮਾਣ ਕਰਦੇ ਹਾਂ ਸਤਿ ਸ਼੍ਰੀ ਅਕਾਲ ਬੁਲਾਉਦੇ ਹਾਂ ਬਹੁਤ ਹੀ ਪਿਆਰ ਨਾਲ ਆਪਣੇ ਅੰਦਰ ਬਿਠਾਉਂਦੇ ਹਾਂ ਪਿਆਰ ਕਰਦੇ ਹਾਂ ਸਤਿਕਾਰ ਕਰਦੇ ਹਾਂ ਹਾਲ ਚਾਲ ਪੁੱਛਦੇ ਹਾਂ ਘਰ ਦਾ ਪਰਿਵਾਰ ਦਾ ਉਹਨਾਂ ਦਾ ਸਭ ਦਾ ਅਤੇ ਉਹਨਾਂ ਲਈ ਬਹੁਤ ਕਿਸਮ ਦੀਆਂ ਚੀਜ਼ਾਂ ਪਕਾਉਣੀਆਂ ਪਸੰਦ ਕਰਦੇ ਹਾਂ ਜਿੱਦਾਂ ਕਿ ਚਾਹ ਨਾਲ ਬਰੈੱਡ ਪਕੌੜੇ ਹੋ ਗਏ ਹੋਰ ਕਚੌਰੀਆਂ ਹੋ ਗਈਆਂ ਗੁਲਗਲੇ ਹੋ ਗਏ ਅਤੇ ਰੋਟੀ ਵਿੱਚ ਦਾਲ ਸਬਜ਼ੀ ਪਨੀਰ ਚੌਲ ਅਤੇ ਖੀਰ ਕੜਾਹ ਇਹ ਸਭ ਬਣਾਉਣਾ ਪਸੰਦ ਕਰਦੇ ਹਾਂ ਅਤੇ ਉਹਨਾਂ ਦੀ ਬਹੁਤ ਹੀ ਆਉ ਭਗਤ ਕਰਦੇ ਹਾਂ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਹਾਂ ਬਹੁਤ ਸਾਰੇ ਕਿਸਮ ਦੀਆਂ ਚੀਜ਼ਾਂ ਅਤੇ ਪਕਵਾਨ ਉਹਨਾਂ ਲਈ ਤਿਆਰ ਕਰਦੇ ਹਾਂ ਉਹਨਾਂ ਨੂੰ ਖੁਸ਼ ਕਰਨ ਲਈ ਬਹੁਤ ਜ਼ਿਆਦਾ ਕਿਸਮ ਦੇ ਪਕਵਾਨ ਬਣਾ ਕੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਹਾਂ ਬਹੁਤ ਵਧੀਆ ਢੰਗ ਨਾਲ ਉਹਨਾਂ ਵਿੱਚ ਵਿਚਰਦੇ ਹਾਂ ਬੈਠਦੇ ਹਾਂ ਗੱਲਾਂ ਬਾਤਾਂ ਕਰਦੇ ਹਾਂ